ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਾਈ ਜੀ ਸਿਟੀ ਸ਼ੂਜ ਹਾਊਸ ਤੋਂ ਬੋਲਦੇ ਹੋ ਪਿਛਲੇ ਹਫ਼ਤੇ ਮੈਂ ਦੋ ਜੁੱਤੇ ਬੂਟਾਂ ਦੇ ਮੰਗਵਾਏ ਸੀ ਤੁਹਾਡੇ ਕੋਲੋਂ ਜੋ ਕਿ ਬਹੁਤ ਵਧੀਆ ਨਿਕਲੇ ਨੇ ਜਦੋਂ ਮੈਂ ਤੁਹਾਡਾ ਪਾਰਸਲ ਰਿਸੀਵ ਕਰਨ ਵਾਸਤੇ ਬਾਹਰ ਗਿਆ ਤਾਂ ਪਾਰਸਲ ਦੀ ਪੈਕਿੰਗ ਬਹੁਤ ਵਧੀਆ ਸੀ ਜਦੋਂ ਮੈਂ ਜੁੱਤਿਆਂ ਨੂੰ ਪਾ ਕੇ ਦੇਖਿਆ ਉਹ ਬਹੁਤ ਹੀ ਜ਼ਿਆਦਾ ਕੰਫਰਟੇਬਲ ਸੀ ਅਤੇ ਮੈਂ ਪਿਛਲੇ ਚਾਰ ਪੰਜ ਦਿਨਾਂ ਤੋਂ ਉਹਨਾਂ ਨੂੰ ਪਾ ਰਿਹਾ ਹਾਂ ਅਤੇ ਉਹ ਬਹੁਤ ਹੀ ਵਧੀਆ ਹਨ ਅਤੇ ਮੈਂ ਤੁਹਾਡੇ ਅੱਗੇ ਤੋਂ ਵੀ ਤੁਹਾਡੇ ਕੋਲੋਂ ਹੀ ਜੁੱਤਿਆਂ ਦਾ ਆਰਡਰ ਕਰਿਆ ਕਰਾਂਗਾ ਅਤੇ ਹੋਰ ਵੀ ਮੈਨੂੰ ਦੱਸਿਉ ਅਤੇ ਵੱਖਰੀ ਕੁਆਲਿਟੀ ਦੇ ਜੋ ਜੋ ਤੁਹਾਡੇ ਕੋਲ ਜੁੱਤੇ ਜਾਂ ਚੱਪਲਾਂ ਹਨ ਤਾਂ ਕਿ ਮੈਂ ਹੋਰ ਵੱਧ ਤੋਂ ਵੱਧ ਆਰਡਰ ਤੁਹਾਡੀ ਕੰਪਨੀ ਤੋਂ ਕਰਾਂ ਧੰਨਵਾਦ